ਬਰਤਨਾਂ ਨੂੰ ਆਪਾਂ ਠੇਠ ਪੰਜਾਬੀ 'ਚ ਭਾਂਡੇ ਵੀ ਕਹਿ ਦਿੰਦੇ ਹਾਂ ਜਿਵੇਂ ਆਪਣੀਆਂ ਪੁਰਾਣੀਆਂ ਬੀਬੀਆਂ ਕਹਿ ਦਿੰਦੀਆਂ ਸੀ ਵੀ ਭਾਂਡੇ ਧੋ ਲਈਏ ਹੁਣ ਉਹਨਾਂ ਸਮਿਆਂ 'ਚ ਤਾਂ ਉਹ ਬਰਤਨ ਚੁੱਲ੍ਹਿਆ ਦੀ ਸਵਾਹਾਂ ਨਾਲ ਧੋਂਦੇ ਹੁੰਦੇ ਸੀ ਕਿੰਨਾ ਮਰਜ਼ੀ ਤੇਲ ਲੱਗਾ ਹੋਵੇ ਕਿੰਨਾ ਮਰਜ਼ੀ ਘਿਓ ਲੱਗਿਆ ਹੋਵੇ ਭਾਂਡਿਆਂ 'ਤੇ ਜਦੋਂ ਪੁਰਾਣੀਆਂ ਬੀਬੀਆਂ ਆਪਣੀਆਂ ਮੁੱਠੀ ਭਰ ਕੇ ਸਵਾਹ ਦੀ ਜਦੋਂ ਮਾਰਦੀਆਂ ਸੀ ਭਾਂਡੇ 'ਚ ਅਤੇ ਭਾਂਡਾ ਤਾਂ ਐ ਸ਼ੀਸ਼ੇ ਵਾਂਗੂ ਚਮਕਦਾ ਸੀ ਉਦੋਂ ਸਮੇਂ ਦੇ ਨਾਲ ਨਾਲ ਬਦਲਾਅ ਆਉਂਦੇ ਗਏ ਫਿਰ ਸਾਬਣ ਚੱਲ ਪਏ ਸਾਬਣਾਂ ਨਾਲ ਧੋਣ ਲੱਗ ਗਈਆਂ ਲੱਗ ਗਏ ਲੋਕ ਭਾਂਡਿਆਂ ਨੂੰ ਬਰਤਨਾਂ ਨੂੰ ਸਾਬਣ ਚੱਲ ਪਏ ਫਿਰ ਭਾਂਡੇ ਧੋਣ ਵਾਲੀਆਂ ਹੋਰ ਚੀਜ਼ਾਂ ਆ ਗਈਆਂ ਹੁਣ ਅੱਜ ਕੱਲ੍ਹ ਲਿਕੁਡ ਜੈਲਾਂ ਵੀ ਆਈਆਂ ਲਿਕੁਡ ਜੈਲਾਂ ਨਾਲ ਵੀ ਭਾਂਡੇ ਧੋਤੇ ਜਾਂਦੇ ਹਨ ਪਹਿਲਾਂ ਤਾਂ ਮੰਨ ਲਓ ਖੇਤ 'ਚ ਚਾਹ ਬਣਾਈ ਅਤੇ ਉੱਥੋਂ ਚੱਕਿਆ ਮਿੱਟੀ ਅਤੇ ਨਾਲੇ ਚੱਕਿਆ ਘਾਹ ਅਤੇ ਭਾਂਡੇ ਐ ਧੋ ਦਈਦੇ ਸੀਗੇ ਵੀ ਐ ਭਾਂਡੇ ਪੂਰੇ ਸਾਫ ਹੋ ਜਾਂਦੇ ਸੀ ਅਤੇ ਤੇਲ ਵਾਲਿਆਂ ਲਈ ਤਾਂ ਹੁਣ ਲਿਕੁਡ ਜੈਲਾਂ ਬਹੁਤ ਆ ਗਈਆਂ ਉਹਨਾਂ ਨਾਲ ਫਿਰ ਭਾਂਡੇ ਬਰਤਨ ਸਾਫ ਹੁੰਦੇ ਆ ਧੰਨਵਾਦ ਜੀ